ਹੈਲੋ ਹਾਂਜੀ ਹਾਂਜੀ ਹਾਂਜੀ ਸਰ ਫਰਨੀਚਰ ਆਲੀ ਦੁਕਾਨ ਤੋਂ ਬੋਲ ਰਹੇ ਸਰ ਹਾਂਜੀ ਸਰ ਮੈਂ ਇਹ ਪੁੱਛਣਾ ਚਾਹੁੰਦਾ ਥੋੜੀ ਇੰਨਕੁਆਰੀ ਚੀਜ ਦੇ ਸਕਦੇ ਓ ਪਲੀਸ ਇੰਨਕੁਆਰੀ ਇਹ ਹੈ ਸਰ ਕਿ ਆਪਣੇ ਕੋਲ ਨਾ ਓਲਡ ਫਰਨੀਚਰ ਪਿਆ ਸਰ ਬੈੱਡ ਤੇ ਸੋਫਾ ਸਰ ਹਾਂਜੀ ਉਹ ਨਾ ਐਕਸਚੇਂਜ ਕਰਵਾਣੇ ਸੀ ਸਰ ਕੋਈ ਪੋਲਸੀ ਹੈ ਤੁਹਾਡੇ ਕੋਲ ਐਕਸਚੇਂਜ ਦੀ ਕਿੰਨੇ ਪਰਸੈਂਟ ਐਕਸਚੇਂਜ ਚ ਲਓਗੇ ਤੇ ਕੀ ਦਿਓਗੇ ਕੁਛ ਦੱਸ ਸਕਦੇ ਓ ਸਰ ਇਸ ਬਾਰੇ ਥੋੜਾ ਟਾਈਮ ਈ ਹੋਇਆ ਸਰ ਲਿੱਤੇ ਨੂੰ ਹਜੇ ਵਧੀਆ ਕੰਡੀਸ਼ਨ 'ਚ ਪਿਆ ਸਰ ਹਾਂਜੀ ਬਹੁਤ ਵਧੀਆ ਕੰਡੀਸ਼ਨ ਐ ਸਰ ਤੁਸੀਂ ਦੇਖੋਗੇ ਨਾ ਜਦੋਂ ਕੀ ਐ ਤਾਂ ਸਰ ਦੇਖੋਗੇ ਤਾਂ ਤਾਡਾ ਰੀਸੇਲ ਵੀ ਹੋ ਸਕਦਾ ਸਰ ਉਨ ਦੇ ਵਿੱਚ ਠੀਕ ਐ ਸਰ ਹਾਂਜੀ ਹਾਂਜੀ ਠੀਕ ਐ ਸਰ ਠੀਕ ਐ ਜੀ ਠੀਕ ਐ ਜੀ ਠੀਕ ਐ ਸਰ ਠੀਕ ਐ ਸਰ ਠੀਕ ਐ ਜੀ ਠੀਕ ਐ ਜੀ ਠੀਕ ਐ ਜੀ ਠੀ ਸਰ ਇੱਕ ਗੱਲ ਹੋਰ ਸੈਲ ਦੀ ਬਹੁਤ ਵਧੀਆ ਚ ਬਣਿਆ ਹੋਇਆ ਸਰ ਫਰਨੀਚਰ ਸਰ ਬਹੁਤ ਰੀਝ ਨਾਲ ਬਣਾਇਆ ਸੀ ਹਾਂਜੀ ਸਰ ਤੇ ਇੱਕ ਗੱਲ ਹੋਰ ਪੁੱਛਣਾ ਆਪਣੇ ਕੋਲ ਨਵਾਂ ਮਿਲ ਜਾਏਗਾ ਹੈਨਾ ਸਮਾਨ ਨਵਾਂ ਚ ਆਪਣੇ ਕਿਹੜੇ ਕਿਹੜੇ ਡਿਜਾਇਨ ਲੇਟੈਸਟ ਮੇਨ ਹੋਣਗੇ ਸਾਰੇ ਟੋਟਲ ਬੈੱਡ ਚ ਤੇ ਸੋਫੇ ਚ ਬੈੱਡ ਸਰ ਦੇਖਨਾ ਪੁੱਛਣਾ ਇਹ ਚਾਹੁੰਨਾ ਜਿਵੇਂ ਸੋਫਾ ਐ ਕੱਮ ਬੈੱਡ ਬਣ ਜਾਂਦਾ ਐ ਜਾਂ ਕੱਮ ਜੋ ਇਸ ਤਰ੍ਹਾਂ ਦੇ ਸਟਾਇਲ ਚ ਠੀਕ ਐ ਫੋਲਡ ਹੋ ਜਾਂਦਾ ਐ ਠੀਕ ਐ ਹਾਂਜੀ ਠੀਕ ਐ ਸਰ ਹੂੰ ਹੂੰ ਠੀਕ ਐ ਸਰ ਹੂੰ ਹੂੰ ਹੂੰ ਹਾਂਜੀ ਠੀਕ ਐ ਜੀ ਸਿੰਪਲ ਜਾਂ ਹੂੰ ਠੀਕ ਐ ਸਰ ਜੇ ਸਰ ਹਾਂਜੀ ਠੀਕ ਐ ਸਰ ਜੇ ਦੇਖਿਆ ਜੇ ਮੰਨ ਲੋ ਹੁਣ ਤੁਸੀਂ ਓਡਰ ਤੇ ਵੀ ਬਣਾ ਦਿੰਦੇ ਓ ਮੇਰੇ ਖਿਆਲ ਚ ਮੈਂ ਸੁਣਿਆ ਸੀ ਓਡਰ ਤੇ ਜਿਵੇਂ ਹੁਣ ਬੈੱਡ ਦਾ ਜਿਵੇਂ ਰੂਮ ਦਾ ਸਾਈਜ਼ ਆ ਆਪਣੇ ਕੋਲ ਦਸ ਵੀ ਐ ਜਾਂ ਹੋਰ ਐ ਜਿਆਦਾ ਉਹ ਸਾਨੂੰ ਮੀਜ਼ਰਮੈਂਟ ਕਰਕੇ ਤੁਸੀਂ ਬਣਵਾ ਦਿਓਗੇ ਹੈਨਾ ਹਾਂਜੀ ਐਕਚੁਲੀ ਜਿਹੜੀ ਤੁਸੀਂ ਹਾਂਜੀ ਠੀਕ ਐ ਜੀ ਠੀਕ ਐ ਜੀ ਹੂੰ ਹੂੰ ਹੂੰ ਠੀਕ ਐ ਜੀ ਤੇ ਇੱਕ ਚੀਜ ਹੋਰ ਪੁੱਛਣਾ ਚਾਹੁੰਦਾ ਸੀ ਜਿਵੇਂ ਤੁਸੀਂ ਬਣਵਾ ਤਾਂ ਦਿੰਦੇ ਜੇ ਓਡਰ ਪਿੱਛੇ ਢੋ ਨਾਲ ਲੈਣੀ ਹੋਵੇ ਸਿੱਧਾ ਫਲੈਟ ਰੱਖਣਾ ਹੋਵੇ ਮਤਲਬ ਕੀ ਜਿਹੜੀ ਵੋਲ ਐ ਵੋਲ ਦੇ ਨਾਲ ਈ ਆਪਾਂ ਸਟੈਂਡ ਕਰਕੇ ਮਤਲਬ ਕੀ ਉੱਪਰ ਬਣਾ ਦੇਈਏ ਬੈਕ ਸੈਡ ਉਨ ਦੀ ਬੈੱਡ ਦੇ ਮਗਰ ਉਹ ਵੀ ਸ਼ੈਦ ਮੇ ਬੀ ਸ਼ੈਦ ਤੁਸੀਂ ਬਣਾ ਸਕਦੇ ਜੇ ਹੈਨਾ ਹਾਂਜੀ ਤੇ ਠੀਕ ਠੀਕ ਐ ਜੀ ਤੇ ਠੀਕ ਐ ਇੰਸਟੋਲਮੈਂਟਸ ਤੇ ਵੀ ਕਰ ਲੈਂਦੇ ਜੇ ਕੇ ਨਈਂ ਸਰ ਇੰਸਟੋਲਮੈਂਟ ਵੀ ਦੇ ਦਿੰਦੇ ਹੈਨਾ ਇੰਸਟੋਲਮੈਂਟ ਤੇ ਵੀ ਦੇ ਦਿੰਦੇ ਕੁਛ ਠੀਕ ਐ ਜੀ ਠੀਕ ਐ ਜੀ ਚਲੋ ਸਰ ਮੈਂ ਵਿਜਿਟ ਕਰਾਂਗਾ ਤੁਹਾਡੀ ਦੁਕਾਨ ਤੇ ਬਹੁਤ ਜਲਦੀ ਫੇਰ ਆਪਾਂ ਕਰਦੇ ਆਂ ਬੈਠ ਕੇ ਠੀਕ ਐ ਹਾਂਜੀ ਹਾਂਜੀ

ਹਾਂਜੀ ਹਾਂਜੀ ਬੈੱਡ ਤੇ ਸੋਫਾ ਕੱਮ ਜਾਂ ਸੋਫਾ ਕੱਮ ਬੈੱਡ ਮਿਲਜੇ ਠੀਕ ਐ ਠੀਕ ਐ ਓਕੇ ਓਕੇ ਥੈਂਕਿਊ